ਬਾਈ ਜੀ ਅਜੀਤ ਸਿੰਘ ਬੋਲਦੇ ਹੋ ਜੀ ਟੂਰਿਸਟ ਗਾਈਡ ਆਪਾਂ ਨੇ ਫਤਿਹਗੜ੍ਹ ਸਾਹਿਬ ਘੁੰਮਣ ਆਉਣਾ ਸੀ ਵੀਰੇ ਇੱਥੇ ਕੀ ਕੀ ਆ ਘੁੰਮਣ ਨੂੰ ਯਾਰ

ਹਾਂਜੀ ਹੋਰ ਹਾਂਜੀ ਹਾਂਜੀ ਹਾਂਜੀ ਅੱਛਾ ਜੀ

ਅੱਛਾ ਜੀ ਅਤੇ ਆਪਣੇ ਚਾਰਜ ਕਿੰਨਾ ਆਉਗਾ ਜੀ ਆਪਾਂ ਬਸ ਜੀ ਇੱਕ ਦਿਨ ਵਾਸਤੇ ਹੀ ਆਉਣਾ ਜੀ ਅੱਪ ਡਾਊਨ ਏ ਕਰਨੀ ਮਤਲਬ ਹਾਂ ਜੀ ਇੱਕ ਦਿਨ ਵਾਸਤੇ ਹਾਂ ਹਾਂ ਜੀ ਹਾਂਜੀ ਹਾਂਜੀ ਪੰਦਰਾਂ ਹਜ਼ਾਰ ਨਹੀਂ ਜੀ ਥੋੜ੍ਹੀ ਘੱਟ ਕਰੋ ਚਲੋ ਉਹ ਤਾਂ ਦੇਖਦੇ ਆਪਾਂ ਕਰ ਲਵਾਂਗੇ ਜੀ ਰਲ ਕੇ ਬੈਠ ਕੇ ਹਾਂ ਅਤੇ ਮੇਰੀ ਫੈ ਹਾਂ ਮੇਰੀ ਫੈਮਲੀ ਆ ਜੀ ਬਸ ਚਾਰ ਜਣੇ ਚਾਰ ਜਣੇ ਆਪਾਂ ਫੈਮਿਲੀ 'ਚ

ਹਾਂਜੀ ਠੀਕ ਹੈ ਜੀ ਅਤੇ ਅਤੇ ਹੋਰ ਕੋਈ ਪਾਰਕ ਨਹੀਂ ਹੈ ਜੀ ਇੱਥੇ ਫਤਿਹਗੜ੍ਹ ਸਾਹਿਬ 'ਚ ਪਾਰਕ ਹੈਗੀ ਅੱਛਾ ਜੀ ਅੱਛਾ ਜੀ ਆਪਾਂ ਜ਼ਿਆਦਾ ਟਾਈਮ ਨਹੀਂ ਜ਼ਿਆਦਾ ਸਮਾਂ ਨਹੀਂ ਲਾਉਣਾ ਜੀ ਆਪਾਂ ਨੇ ਮਤਲਬ ਮੈਂ ਇੱਥੇ ਲੁਧਿਆਣੇ ਤੋਂ ਆਉਣਾ ਸ਼ਾਮ ਨੂੰ ਮੁੜ ਜਾਣਾ ਆਪਾਂ ਨੇ ਸ਼ਾਮ ਨੂੰ ਮੁੜ ਜਾਣਾ ਆਪਾਂ ਠੀਕ ਹੈ ਕੋ ਕੋ ਆਪਾਂ ਆਵਾਂਗੇ ਇੱਕ ਦਸੰਬਰ ਨੂੰ ਬਾਅਦ ਠੀਕ ਹੈ ਜੀ ਠੀਕ ਹੈ ਜੀ ਓਕੇ